ਵੈਸੇ ਤਾਂ ਅੱਜ ਕੱਲ੍ਹ ਹਰ ਘਰ ਵਿੱਚ ਕਾਰਾਂ ਮੋਟਰਸਾਈਕਲ ਗੱਡੀਆਂ ਆਵਾਜਾਈ ਦੇ ਸਾਧਨ ਹਰ ਕਿਸੇ ਨੇ ਆਪਣੇ ਵਾਸਤੇ ਰੱਖੇ ਹੋਏ ਹਨ ਪਰ ਜੇ ਸ਼ਹਿਰ ਤੋਂ ਬਾਹਰ ਜਾਣਾ ਹੈ ਤਾਂ ਬੱਸ ਸਟੈਂਡਾਂ ਵਿੱਚੋਂ ਬੱਸਾਂ ਰਾਹੀ ਜਾਇਆ ਜਾਂਦਾ ਹੈ ਅਤੇ ਟੈਕਸੀ ਵਗੈਰਾ ਵੀ ਬੁੱਕ ਕੀਤੀ ਜਾਂਦੀ ਹੈ ਅਤੇ ਜੇ ਆਪਣੇ ਸਟੇਟ ਤੋਂ ਬਾਹਰ ਜਾਣਾ ਹੈ ਤਾਂ ਟ੍ਰੇਨਾਂ ਵਿੱਚ ਵੀ ਜਾਂਦੇ ਹਨ ਲੋਕ ਟ੍ਰੇਨਾਂ ਰਾਹੀ ਆਵਾਜਾਈ ਦੇ ਸਾਧਨ ਵਰਤਦੇ ਹਨ ਅਤੇ ਜੇ ਤੁਸੀਂ ਆਪਣੀ ਸਟੇਟ ਤੋਂ ਬਾਹਰ ਜਲਦੀ ਜਾਣਾ ਹੈ ਜਾਂ ਫਿਰ ਕੋਈ ਐਮਰਜੰਸੀ ਜਲਦੀ ਪਹੁੰਚਣਾ ਹੈ ਤਾਂ ਉਹ ਚੰਡੀਗੜ੍ਹ ਤੋਂ ਜੇ ਪੰਜਾਬ ਤੋਂ ਬਾਹਰ ਜਾਣਾ ਹੈ ਤਾਂ ਚੰਡੀਗੜ੍ਹ ਤੋਂ ਏਅਰਲਾਈਨ ਯੂਜ ਕਰ ਸਕਦੇ ਹਨ ਅਤੇ ਉੱਥੋਂ ਕਰਦੇ ਹਨ ਚੰਡੀਗੜ੍ਹ ਏਅਰਪੋਰਟ ਤੋਂ ਏਅਰਲਾਈਨ ਯੂਜ ਕਰਦੇ ਹਨ ਅਤੇ ਇਸ ਤਰ੍ਹਾਂ ਨਾਲ ਵੱਖ ਵੱਖ ਜਗ੍ਹਾ' ਤੇ ਜਾਣ ਵਾਸਤੇ ਵੱਖ ਵੱਖ ਤਰ੍ਹਾਂ ਦੇ ਆਵਾਜਾਈ ਦੇ ਸਾਧਨ ਨੇ ਟਰਾਂਸਪੋਰਟ ਵਰਤਦੇ ਹਨ ਅਤੇ ਜਦੋਂ ਕੋਈ ਬਾਹਰੋਂ ਸਮਾਨ ਮੰਗਵਾਉਣਾ ਹੈ ਤਾਂ ਟਰਾਂਸਪੋਰਟ ਟਰੱਕ ਵਰਤੇ ਜਾਂਦੇ ਹਨ ਜਾਂ ਬਾਹਰ ਭੇਜਣਾ ਹੈ ਤਾਂ ਉਹ ਵੀ ਟਰਾਂਸਪੋਰਟ ਜ਼ਰੀਏ ਜਾਂਦਾ ਹੈ ਅਤੇ ਇਸ ਤਰ੍ਹਾਂ ਹਰ ਇਨਸਾਨ ਆਪਣੇ ਦੂਸਰੇ ਹਿਸਾਬ ਨਾਲ ਦੇਖੀਏ ਤਾਂ ਆਪਣੇ ਆਮਦਨ ਦੇ ਹਿਸਾਬ ਨਾਲ ਟਰਾਂਸਪੋਰਟ ਵਰਤਦਾ ਹੈ ਕਿ ਜਿਹੜਾ ਬੰਦਾ ਤਾਂ ਥੋੜ੍ਹਾ ਅਮੀਰ ਹੈ ਉਹ ਕਾਰ ਯੂਜ ਕਰਦਾ ਹੈ ਅਤੇ ਜਿਹੜਾ ਥੋੜ੍ਹਾ ਮੀਡੀਅਮ ਹੈ ਉਹ ਬੱਸ ਰਾਹੀਂ ਟਰਾਂਸਪੋਰਟ ਆਪਣਾ ਕੰਮ ਚਲਾਉਂਦਾ ਹੈ ਅਤੇ ਲੋਕਲ ਚੱਲਣ ਵਾਸਤੇ ਮੋਟਰਸਾਈਕਲ ਸਕੂਟਰ ਰੱਖੇ ਹੋਏ ਹਨ ਇਸ ਤਰ੍ਹਾਂ ਨਾਲ ਅਲੱਗ ਅਲੱਗ ਤਰ੍ਹਾਂ ਨਾਲ ਅਲੱਗ ਅਲੱਗ ਟਰਾਂਸਪੋਰਟ ਸਿਸਟਮ ਯੂਜ ਕੀਤਾ ਜਾਂਦਾ ਹੈ